ਇੱਕ ਸਿਹਤਮੰਦ ਸਰੀਰ ਹੀ ਇੱਕ ਸਿਹਤਮੰਦ ਵਿਅਕਤੀ ਦੀ ਪਛਾਣ ਹੁੰਦਾ ਹੈ ਇਹ ਅਕਸਰ ਪਿੰਡਾਂ ਵਿੱਚ ਕਿਹਾ ਜਾਂਦਾ ਹੈ ਅਗਰ ਕੋਈ ਵਿਅਕਤੀ ਪਤਲਾ ਜਾਂ ਦੁਬਲਾ ਪਤਲਾ ਦੇਹ ਦਾ ਹੈ ਤਾਂ ਹਰ ਕੋਈ ਉਹਦਾ ਮਜ਼ਾਕ ਬਣਾਉਂਦਾ ਹਰ ਕੋਈ ਉਸਨੂੰ ਪਤਲਾ ਪਤਲਾ ਆਖ ਕੇ ਚਿੜਾਉਂਦਾ ਹੈ ਇਹ ਪਿੰਡਾਂ ਵਿੱਚ ਜੇਕਰ ਕੋਈ ਵਿਅਕਤੀ ਆਪਣਾ ਭਾਰ ਵਧਾਉਣਾ ਚਾਹੁੰਦਾ ਹੈ ਅਤੇ ਜਾਂ ਫਿਰ ਇੱਕ ਸਿਹਤਮੰਦ ਸਰੀਰ ਬਣਾਉਣਾ ਚਾਹੁੰਦਾ ਹੈ ਤਾਂ ਉਹ ਵੱਧ ਤੋਂ ਵੱਧ ਉਹ ਪ੍ਰੋਟੀਨ ਅਤੇ ਫਾਈਬਰਸ ਵਾਲੀਆਂ ਚੀਜ਼ਾਂ ਖਾਂਦਾ ਹੈ ਜਿਵੇਂ ਕਿ ਉਹ ਵੱਧ ਤੋਂ ਵੱਧ ਪਨੀਰ ਘਿਓ ਸ਼ੱਕਰ ਆਦਿ ਖਾਂਦਾ ਹੈ ਜਿਵੇਂ ਕਿ ਮਲਾਈ ਜਾਂ ਮੱਖਣ ਆਦਿ ਖਾਂਦਾ ਹੈ ਤਾਂ ਕਿ ਉਹ ਵੱਧ ਤੋਂ ਵੱਧ ਆਪਣਾ ਭਾਰ ਵਧਾ ਸਕੇ ਇਸ ਤੋਂ ਇਲਾਵਾ ਉਹ ਆਪਣੀ ਕੈਲਰੀਜ 'ਤੇ ਪੂਰਾ ਧਿਆਨ ਰੱਖਦਾ ਹੈ ਵੱਧ ਤੋਂ ਵੱਧ ਫਾਈਬਰਸ ਆਦਿ ਲੈਂਦਾ ਹੈ ਤਾਂ ਕਿ ਉਹ ਇੱਕ ਚੰਗਾ ਸਿਹਤਮੰਦ ਸਰੀਰ ਬਣਾ ਸਕੇ ਇਸ ਤੋਂ ਇਲਾਵਾ ਉਹ ਆਪਣੀ ਸਰੀਰ ਆਪਣੀ ਖਾਣੇ ਦੇ ਵਿੱਚ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਐਡ ਕਰਦਾ ਹੈ ਵੱਧ ਤੋਂ ਵੱਧ ਕੈਲਰੀਸ ਆਪਣੀ ਡਾਇਟ ਦੇ ਵਿੱਚ ਐਡ ਕਰਦਾ ਹੈ ਤਾਂ ਕਿ ਉਹ ਇੱਕ ਚੰਗੀ ਡਾਇਟ ਲੈ ਸਕੇ ਇਸ ਤਰ੍ਹਾਂ ਉਹ ਆਪਣੇ ਸ਼ ਭਾਰ ਨੂੰ ਵਧਾ ਸਕਦਾ ਹੈ ਅਤੇ ਇੱਕ ਸਿਹਤਮੰਦ ਸਰੀਰ ਬਣਾ ਸਕਦਾ ਹੈ